ਹੈਲੋ ਨਮਸਕਾਰ ਸਰ ਜੀ ਸਰ ਮਾਨਸਾ ਤੋਂ ਡਿ ਬੁੱਕ ਡਿਪੂ ਗੱਲ ਕਰ ਰਹੇ ਹੋ ਜੀ

ਹਾਂਜੀ ਹਾਂਜੀ ਸਰ ਇੱਕ ਨਾ ਅਸੀਂ ਕਿਤਾਬਾਂ ਲੈ ਕੇ ਗਏ ਤੁਹਾਡੀ ਦੁਕਾਨ ਤੋਂ ਜੀ ਪਿਛਲੇ ਮੰਥ ਲੈ ਕੇ ਗਏ ਸੀ ਜੀ ਚੌਵੀ ਤਰੀਕ ਨੂੰ ਜੀ ਹਾਂਜੀ ਹਾਂਜੀ ਉਹਦਾ ਨਾ ਸਾਨੂੰ ਬਿਲ ਚਾਹੀਦਾ ਜੀ ਕਿਤਾਬਾਂ ਦਸਵੀਂ ਕਲਾਸ 'ਚ ਪੜ੍ਹਦਾ ਜੀ ਬੱਚਾ ਹਾਂਜੀ ਹਾਂਜੀ ਪੰਜਾ ਅ ਸਾਰੇ ਸਬਜੈਕਟ ਲੈ ਕੇ ਗਏ ਸੀ ਜੀ ਹਾਂਜੀ ਪੰਜਾਬੀ ਸੀ ਜੀ ਇੰਗਲਿਸ਼ ਜੀ ਹਿਸਟਰੀ ਜੀ ਹ ਅਤੇ ਮੈਂਥ ਜੀ ਹਾਂਜੀ ਸਾਇੰਸ ਵਗੈਰਾ ਵੀ ਪਹਿਲਾਂ ਚਲੀ ਨਹੀਂ ਨਹੀਂ ਉਹ ਪਹਿਲਾਂ ਚਲੀਆਂ ਗਈਆਂ ਸੀ ਜੀ ਹਾਂਜੀ ਹਾਂਜੀ ਸਾਨੂੰ ਇਹ ਕਿਤਾਬਾਂ ਦਾ ਸਾਨੂੰ ਬਿੱਲ ਚਾਹੀਦਾ ਸੀ ਜੀ ਅ ਹਾਂਜੀ ਇਹ ਸਾਨੂੰ ਥੋੜ੍ਹਾ ਜਿਹਾ ਕਿਸੇ ਦਾ ਕੰਮ ਸੀ ਜੀ ਕਿਸੇ ਬੰਦੇ ਨੇ ਕਿਹਾ ਸੀਗਾ ਜੀ ਪਰਸੋਂ ਤੱਕ ਜੇ ਥੋੜ੍ਹਾ ਜਲਦੀ ਕਰਵਾ ਦਿਓ ਜੀ ਕੱਲ੍ਹ ਜੀ ਥੋੜ੍ਹਾ ਥੋੜ੍ਹਾ ਜਲਦੀ ਹੋਰ ਦੇਖ ਲਓ ਜੀ ਜੇ ਅੱਜ ਸ਼ਾਮ ਤੱਕ ਹੋ ਜਾਵੇ ਜੀ ਸਵੇਰੇ ਪੱਕਾ ਹੋ ਜਾਣਾ ਜੀ

ਠੀਕ ਹੈ ਜੀ ਠੀਕ ਹੈ ਜੀ ਮਾੜਾ ਚੈੱਕ ਕਰ ਕੇ ਦੱਸ ਦਿਓ ਇੱਕ ਵਾਰੀ ਜੀ ਹਰਸ਼ਵਰਧਨ ਨਾਮ 'ਤੇ ਗਿਆ ਹੋਊਗਾ ਜੀ ਠੀਕ ਹੈ ਸਰ ਓਕੇ ਬਾਈ ਥੈਂਕ ਥੈਂਕ ਯੂ ਜੀ